ਮੈਂ ਤੈਰਾਕੀ ਸਿੱਖਣ ਵਿੱਚ ਆਪਣੇ ਕਈ ਦੋਸਤਾਂ ਦੀ ਮਦਦ ਕੀਤੀ ਹੈ ਕਿਉਂਕਿ ਮੈਂ ਖੁਦ ਵੀ ਇਹ ਮੁਸ਼ਕਿਲ ਫੇਸ ਕੀਤੀ ਸੀ ਅਤੇ ਮੈਂ ਇੱਕ ਵਾਰੀ ਡੁੱਬਦੇ ਡੁੱਬਦੇ ਬਚਿਆ ਸੀ ਅਤੇ ਉਸ ਤੋਂ ਬਾਅਦ ਮੈਂ ਵੀ ਤੈਰਾਕੀ ਸਿੱਖੀ ਸੀ ਤੈਰਨਾ ਸਿੱਖਿਆ ਸੀ ਅਤੇ ਮੇਰੇ ਦੋਸਤਾਂ ਕਈ ਦੋਸਤ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਉਹਨਾਂ ਨੇ ਮੈਨੂੰ ਤੈਰਨਾ ਸਿਖਾਇਆ ਸੀ ਅੱਗੋਂ ਜਿਹੜੇ ਮੇਰੇ ਦੋਸਤਾਂ ਨੂੰ ਨਹੀਂ ਤੈਰਨਾ ਆਉਂਦਾ ਸੀ ਉਹਨਾਂ ਨੂੰ ਮੈਂ ਸਿਖਾਇਆ ਅਤੇ ਮੈਂ ਕਈ ਲੋਕਾਂ ਦੀ ਮਦਦ ਵੀ ਕੀਤੀ ਹੈ ਕਿਉਂਕਿ ਤੈਰਨਾ ਸਿੱਖਣਾ ਵੀ ਜ਼ਰੂਰੀ ਹੈ ਕਈ ਵਾਰੀ ਔਂਕੜ ਐਸੀ ਵੀ ਮੁਸ਼ਕਿਲ ਆ ਜਾਂਦੀ ਹੈ ਕਿ ਆਪਾਂ ਪਾਣੀ ਵਿੱਚ ਜਾਂਦੇ ਹਾਂ ਅਤੇ ਆਪਾਂ ਨੂੰ ਤੈਰਨਾ ਨਹੀਂ ਆਉਂਦਾ ਆਪਾਂ ਡੁੱਬ ਸਕਦੇ ਹਾਂ ਅਤੇ ਆਪਾਂ ਨੂੰ ਜਾਨ ਦਾ ਖਤਰਾ ਹੁੰਦਾ ਹੈ ਤੋ ਇਹ ਸਿੱਖਣਾ ਵੀ ਜ਼ਰੂਰੀ ਹੈ ਇਸਦਾ ਐਡਾ ਕੋਈ ਰੋਲ ਨਹੀਂ ਹੁੰਦਾ ਪਰ ਹਰ ਚੀਜ਼ ਆਉਣੀ ਚਾਹੀਦੀ ਹੈ ਬੰਦੇ ਨੂੰ ਮੁਸ਼ਕਿਲ ਤੋਂ ਨਿਕਲਣ ਵਾਸਤੇ